ਹੈਲੋ ਹੈਲੋ ਹੈਲੋ ਸਤਿ ਸ਼੍ਰੀ ਅਕਾਲ ਵਧੀਆ ਤੁਸੀਂ ਸੁਣਾਓ ਆਪਣਾ ਹੋਰ ਅੱਜ ਕੱਲ੍ਹ ਤੁਸੀਂ ਲੱਭਿਆ ਨਹੀਂ ਅੱਛਾ ਅੱਛਾ ਹੋਰ ਮੈਂ ਵੀ ਇਹੀ ਕਹਿੰਦਾ ਇੱਕ ਦਿਨ ਇੱਦਾਂ ਹੀ ਮਤਲਬ ਤੁਹਾਡੇ ਗਾਂਧੀ ਚੌਕ ਗਈ ਸੀ ਪਹਿਲੇ ਤਾਂ ਮਤਲਬ ਕਾਫੀ ਜ਼ਿਆਦਾ ਟਰੈਫਿਕ ਸੀ ਇੱਥੇ ਇੱਕ ਤਾਂ ਫਾਟਕ ਦੀ ਬੜੀ ਪ੍ਰੋਬਲਮ ਹੋ ਗਈ ਵੀ ਆ ਫਾਟਕ ਹਰ ਟਾਈਮ ਜਦੋਂ ਜਾਓ ਬੰਦ ਹੀ ਰਹਿੰਦਾ ਜਿਹੜਾ ਫਾਟਕ ਹਾਂਜੀ ਅਤੇ ਫਿਰ ਮੈਂ ਗਾਂਧੀ ਚੌਕ ਗਈ ਸੀ ਗਾਂਧੀ ਚੌਕ ਵੀ ਮਤਲਬ ਇੰਨੀ ਜ਼ਿਆਦਾ ਟਰੈਫਿਕ ਸੀ ਕਿ ਕੋਈ ਮਤਲਬ ਇੰਨਾ ਮੈਂ ਮਤਲਬ ਗਈ ਠੀਕ ਹੈ ਅੱਧੇ ਘੰਟੇ ਤੱਕ ਮਤਲਬ ਜਿੱਦਾਂ ਬੰਦਾ ਵਾਪ ਵਾਪਸ ਆ ਜਵਾਂਗੀ ਪਰ ਉੱਥੇ ਇੰਨੀ ਜ਼ਿਆਦਾ ਟਰੈਫਿਕ ਸੀ ਕਿ ਮੈਨੂੰ ਉੱਥੇ ਮਤਲਬ ਇੱਕ ਦੋ ਘੰਟਾ ਕਾਫੀ ਮਤਲਬ ਟਾਈਮ ਲੱਗ ਗਿਆ ਹੁਣ ਜਿੱਦਾਂ ਕਿ ਉੱਥੇ ਮੈਂ ਇਹ ਦੇਖਿਆ ਵੀ ਇੱਕ ਐਂਬੂਲੈਂਸ ਕਿ ਉਹ ਮਤਲਬ ਐਂਬੂਲੈਂਸ ਇੰਨੀ ਟਰੈਫਿਕ 'ਚ ਫਸੀ ਵੀ ਸੀ ਅਤੇ ਇੰਨੀ ਟਰੈਫਿਕ ਦੇ ਕਾਰਨ ਉਹ ਵੀ ਮਤਲਬ ਟੈਂਸ਼ਨ ਨਹੀ ਕੁਝ ਪੈ ਗਏ ਸੀ ਉੱਥੇ ਇਹਦੇ ਲਈ ਮਤਲਬ ਸਾਨੂੰ ਕੁਝ ਇੱਦਾਂ ਕਰਨਾ ਚਾਹੀਦਾ ਨਾ ਸੋਲਵ ਕਰਨੀ ਚਾਹੀਦੀ ਹੈ ਇਹ ਚੀਜ਼ਾਂ ਜਿੱਦਾਂ ਸਰਕਾਰ ਨੂੰ ਜਿੱਦਾਂ ਕੁਛ ਮਤਲਬ ਕਹਿਣਾ ਚਾਹੀਦਾ ਕਿ ਸਰਕਾਰ ਨੂੰ ਦੱਸਣਾ ਚਾਹੀਦਾ ਕਿ ਸਾਡੇ ਇੱਥੇ ਇੰਨੀ ਜ਼ਿਆਦਾ ਟਰੈਫਿਕ ਹੈ ਜਿੱਦਾਂ ਮਤਲਬ ਫਾਟਕ ਵੀ ਕਾਫੀ ਟਾਈਮ ਬੰਦ ਹੀ ਰਹਿੰਦਾ ਟਰੈਫਿਕ ਵਾਸਤੇ ਮਤਲਬ ਉਹਨਾਂ ਨੂੰ ਕੁਛ ਨਾ ਕੁਛ ਫਲਾਈ ਓਵਰ ਮਤਲਬ ਜ਼ਿਆਦਾਤਰ ਬਣਨੇ ਚਾਹੀਦੇ ਆ ਜਿੱਦਾਂ ਹੁਣ ਵੀ ਕੰਮ 'ਤੇ ਚੱਲੀ ਦਾ ਪਰ ਅੱਗੇ ਜਿੱਦਾਂ ਹੋਰ ਵੀ ਫਲਾਈ ਓਵਰ ਬਣਨੇ ਚਾਹੀਦੇ ਦੇਖਿਆ ਜਾਵੇ ਟਰੈਫਿਕ ਆ ਜਿਹੜਾ ਉਹ ਘੱਟ ਹੋ ਜਾਵੇ ਅਤੇ ਸਾਨੂੰ ਆਸਾਨੀ ਹੋ ਜਾਵੇ ਅਤੇ ਮੈਟਰੋ ਜਿੱਦਾਂ ਮੈਟਰੋ ਵੀ ਮਤਲਬ ਸਾਡੇ ਇੱਥੇ ਹੋਣੀ ਚਾਹੀਦੀ ਹੈ ਕਿ ਬੰਦੇ ਨੂੰ ਮਤਲਬ ਅਸਾਨੀ ਹੋਏ ਕਿ ਸਾਨੂੰ ਕੋਈ ਟ੍ਰੀਟਮੈਂਟ ਚਾਹੀਦਾ ਹੋਏ ਤਾਂ ਚਲੋ ਠੀਕ ਹੈ ਫਿਰ